ਹੈਲੋ ਸਤਿ ਸ਼੍ਰੀ ਅਕਾਲ ਜੀ ਗੁਰੂ ਨਾਨਕ ਦੇਵ ਟਰੈਵਲ ਏਜੰਸੀ ਤੋਂ ਆਪਣੇ ਬਲਦੇਵ ਭਾਅ ਜੀ ਬੋਲਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਐਕਚੁਲੀ ਨਾ ਮੈਂ ਤੁਹਾਡੇ ਕੋਲੋਂ ਆਪਣੇ ਕੋਈ ਪਰਸੋਂ ਜਿਹੇ ਗੱਡੀ ਕਰਵਾਈ ਸੀ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੱਕ ਦੀ ਹਾਂਜੀ ਕੋਈ ਛੇ ਵਜੇ ਦੀ ਕਰਵਾਈ ਸੀਗੀ ਸ਼ਾਮ ਦੇ ਅੱਛਾ ਹਾਂਜੀ ਉਹ ਗੱਲ ਇਹ ਸੀ ਕਿ ਭਾਅ ਜੀ ਕਿ ਮੈਂ ਆਪਣੇ ਜਾਣਾ ਸੀਗਾ ਕੋਈ ਜ਼ਰੂਰੀ ਕੰਮ ਸੀ ਮੈਨੂੰ ਕਾਫ਼ੀ ਜ਼ਿਆਦਾ ਇੰਪੋਰਟੈਂਟ ਕੰਮ ਸੀ ਅਤੇ ਮੈਂ ਪਹਿਲੀ ਵਾਰ ਜਾਣ ਡਿਆ ਅੰਮ੍ਰਿਤਸਰ ਹਾਂਜੀ ਅਤੇ ਮੈਨੂੰ ਕੁਝ ਪਤਾ ਨਹੀਂ ਸੀ ਵੈਸੇ ਅਤੇ ਤੁਹਾਡਾ ਫਿਰ ਵੀ ਮੈਨੂੰ ਡਰਾਈਵਰ ਮਿਲਿਆ ਉਹ ਆਇਆ ਉੱਥੇ ਜਿੱਥੇ ਮੈਂ ਉਹਨੂੰ ਬੋਲਿਆ ਸੀ ਕਿ ਮੇਰਾ ਐਡਰੈਸ ਆ ਇੱਥੇ ਆਏ ਅਤੇ ਹਾਂਜੀ ਉਹ ਆਇਆ ਅਤੇ ਮੇਰੇ ਨਾਲ ਉਹਨੇ ਗੱਲ ਚੰਗੀ ਤਰ੍ਹਾਂ ਕੀਤੀ ਜਦੋਂ ਮੈਨੂੰ ਲੈ ਕੇ ਵੀ ਜਾਣ ਡਿਆ ਸੀ ਅੰਮ੍ਰਿਤਸਰ ਵੱਲ ਨੂੰ ਅਤੇ ਨਾ ਉਹਨੇ ਕੋਈ ਡ ਡਰਿੰਕ ਕੀਤੀ ਸੀ ਨਾ ਕੋਈ ਵਾਧੂ ਘਾਟੂ ਕੰਮ ਕੀਤੇ ਸੀ ਨਾ ਕੋਈ ਗੱਲ ਇੱਦਾਂ ਦੀ ਕੀਤੀ ਕਿ ਜਿਹਦੇ ਨਾਲ ਮੈਂ ਗੁੱਸਾ ਹੋ ਜਾਵਾਂ ਜਾਂ ਕੁਛ ਹੋ ਜਾਵਾਂ ਹਾਂਜੀ ਉਹਨੇ ਪ੍ਰੋਪਰਲੀ ਗੱਡੀ ਚਲਾਈ ਸਭ ਕੁਝ ਡਰਾਈਵ ਡਰੁਈਵ ਸਭ ਕੀਤਾ ਜਦੋਂ ਮੈਂ ਉੱਥੇ ਪਹੁੰਚਿਆ ਵੀ ਅੰਮ੍ਰਿਤਸਰ ਉੱਥੇ ਜਾ ਕੇ ਵੀ ਉਹਨੇ ਮੈਨੂੰ ਦੱਸਿਆ ਕਿ ਇਹ ਇਹ ਜਗ੍ਹਾ 'ਤੇ ਇਹ ਮਿਲਦਾ ਇੱਥੇ ਇਹ ਵਾ ਇੱਥੇ ਹਾਂਜੀ ਇੱਥੇ ਇਹ ਮਸ਼ਹੂਰ ਜਗ੍ਹਾ ਵਾ ਇੱਥੇ ਤੁਸੀਂ ਇਹ ਕਰ ਸਕਦੇ ਹੋ ਇੱਥੇ ਨੂੰ ਜਾਓਗੇ ਤਾਂ ਇੱਧਰ ਨੂੰ ਇਹ ਰਾਹ ਮੁੜ ਜਾਵੇਗਾ ਸਭ ਕੁਝ ਉਹਨੇ ਮੈਨੂੰ ਬੜੇ ਧਿਆਨ ਨਾਲ ਦੱਸਿਆ ਫਿਰ ਉਹਨੇ ਮੈਨੂੰ ਹਾਂਜੀ ਸਹੀ ਤਰੀਕੇ ਨਾਲ ਉਹਨੇ ਮੈਨੂੰ ਪਰਾ ਪੂਰਾ ਗਾਈਡ ਕੀਤਾ ਕਿ ਬਾਈ ਕਿ ਇੱਥੇ ਇੱਥੇ ਇਹ ਹੈ ਅਤੇ ਫਿਰ ਮੈਨੂੰ ਸਹੀ ਪਤਾ 'ਤੇ ਵੀ ਪਹੁੰਚਾਇਆ ਕਿ ਜਿੱਥੇ ਮੇਰਾ ਜਿਹ ਜਿਹਦੇ ਨਾਲ ਮੈਂ ਟਾਈਮ ਸਿਰ ਆਪਣਾ ਕੰਮ ਕਰ ਪਾਇਆ ਅਤੇ ਸਹੀ ਤਰੀਕੇ ਨਾਲ ਹਾਂਜੀ ਕਿ ਮੈਮ ਮੈਨੂੰ ਤੁਹਾਡੀ ਸਰਵਿਸ ਬੜੀ ਪਸੰਦ ਆਈ ਅਤੇ ਮੈਂ ਅੱਗੇ ਤੋਂ ਵੀ ਤੁਹਾਡੇ ਕੋਲੋਂ ਹੀ ਸਰਵਿਸ ਲੈਣਾ ਚਾਹੂੰਗਾ ਹਾਂਜੀ